ਜਿਵੇਂ ਕਿ ਮੈਂ ਇੱਕ ਪਿੰਡ ਵਿੱਚ ਰਹਿੰਦਾ ਹਾਂ ਕਪੂਰਥਲੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਮੇਰੇ ਨਾਲ ਦੇ ਸਾਰੇ ਸਾਥੀ ਆਰਮੀ ਦੀ ਟ੍ਰੇਨਿੰਗ ਲਈ ਰਨਿੰਗ ਕਰਦੇ ਸੀ ਮੈਨੂੰ ਵੀ ਉਹਨਾਂ ਵੱਲ ਦੇਖ ਕੇ ਦ ਰਨਿੰਗ ਕਰਨ ਦਾ ਸ਼ੌਕ ਪਿਆ ਜਿਹਦੇ ਨਾਲ ਕਿ ਉਹ ਸ਼ੌਕ ਮੇਰਾ ਜ਼ਿਆਦਾ ਅੱਗੇ ਵੱਧਦਾ ਗਿਆ ਅਤੇ ਮੈਨੂੰ ਦੌੜਨਾ ਪਸੰਦ ਆਉਣ ਲੱਗਿਆ ਮੈਂ ਵੀ ਆਰਮੀ ਦੀ ਭਰਤੀ ਲਈ ਤਿਆਰੀ ਕਰਨੀ ਸਟਾਰਟ ਕਰ ਦਿੱਤੀ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਿਆ ਅਤੇ ਮੈਂ ਤੰਦਰੁਸਤ ਰਹਿਣ ਲੱਗਾ ਇਹਦੇ ਨਾਲ ਮੈਨੂੰ ਜਿਹੜਾ ਵੀ ਮੋਟਾਪਾ ਹੁੰਦਾ ਸੀ ਉਹ ਸਭ ਦੂਰ ਹੋ ਗਿਆ ਅਤੇ ਅਤੇ ਮੇਰਾ ਸਰੀਰ ਤੰਦਰੁਸਤ ਹੋ ਗਿਆ ਹੁਣ ਜਿਸ ਜਦੋਂ ਦੀ ਮੈਂ ਦੌੜ ਛੱਡ ਦਿੱਤੀ ਹੈ ਅਤੇ ਮੇਰਾ ਸਰੀਰ ਫਿਰ ਉਸ ਤਰ੍ਹਾਂ ਦਾ ਹੋ ਗਿਆ ਹੈ ਅਤੇ ਮੈਨੂੰ ਹੁਣ ਦੌੜਨਾ